ਸਕੂਲ ਵਿਦਿਆਰਥੀਆਂ ਨੂੰ ਕਲਾ ਅਤੇ ਸ਼ਿਲਪਕਾਰੀ ਸਿਖਾਉਣ ਲਈ ਇੱਕ ਵਿਸ਼ਾ ਜੋ ਹੈ ਕਿ ਡਰੈਂਗ ਦਾ ਵਿਸ਼ਾ ਰਖਾਇਆ ਜਾਂਦਾ ਹੈ ਉਸ ਵਿੱਚ ਉਹਨਾਂ ਨੂੰ ਜਿੱਦਾਂ ਫੁੱਲ ਬਣਾਉਣੇ ਘਰ ਬਣਾਉਣੇ ਕੋਠੀ ਬਣਾਉਣੀ ਕੁੱਤੇ ਬਣਾਉਣੇ ਬਿੱਲੀਆਂ ਬਣਾਉਣੀਆਂ ਆਦਿ ਸਿਖਾਈਆਂ ਜਾਂਦੀਆਂ ਹਨ ਬੱਚਿਆਂ ਨੂੰ ਉਹਨਾਂ ਵਿੱਚ ਰੰਗ ਭਰਨੇ ਸਿਖਾਏ ਜਾਂਦੇ ਹੈ ਬੱਚੇ ਉਹਨਾਂ ਨੂੰ ਬਹੁਤ ਸੋਹਣਾ ਬਣਾਉਣ ਲਈ ਵੱਖ ਵੱਖ ਤਰ੍ਹਾਂ ਦੇ ਕਲਰ ਦੀ ਵਰਤੋਂ ਕਰਦੇ ਹਨ ਉਹਨਾਂ ਦਾ ਜਿਹੜਾ ਉਹ ਡਰੈਂਗ ਦਾ ਵਿਸ਼ਾ ਉਹਨਾਂ ਨੂੰ ਪਲੱਸ ਟੂ ਤੱਕ ਲਿਜਾਇਆ ਜਾਂਦਾ ਹੈ ਜਿਹੜੇ ਬੱਚਿਆਂ ਦਾ ਉਹਨਾਂ ਵਿੱਚ ਜ਼ਿਆਦਾ ਇੰਟਰਸਟ ਹੁੰਦਾ ਉਹਨਾਂ ਨੂੰ ਅੱਗੇ ਵੀ ਆ ਜਿਹੜਾ ਉਹ ਆਰਟ ਐਂਡ ਕ੍ਰਾਫਟ ਲਈ ਲੈ ਲਈ ਲੈ ਲੈਂਦੇ ਹਨ ਜੇ ਆਪਾਂ ਗੱਲ ਕਰੀਏ ਮੇਰੀ ਮਨਪਸੰਦ ਦੀ ਤਾਂ ਮੈਂ ਬਚਪਨ ਵਿੱਚ ਜਦ ਛੋਟੀ ਹੁੰਦੀ ਸੀ ਤਾਂ ਸਾਨੂੰ ਵੀ ਇਸ ਤਰ੍ਹਾਂ ਇੱਕ ਫੁੱਲ ਬਣਾਉਣਾ ਸਿਖਾਇਆ ਜਾਂਦਾ ਸੀ ਜੇ ਗੱਲ ਕਰੀਏ ਗੁੱਡੀਆਂ ਬਣਾਉਣ ਦੀ ਤਾਂ ਮੇਰੀ ਮੰਮੀ ਜੋ ਸੀ ਸਾਨੂੰ ਗੁੱਡੀਆਂ ਬਣਾ ਕੇ ਬਣਾਉਣਾ ਸਿਖਾਉਂਦੀ ਸੀ ਤਾਂ ਉਹਨਾਂ ਦੇ ਕਿੱਦਾਂ ਕੱਪੜੇ ਬਣਾਉਣੇ ਨੇ ਕਿੱਦਾਂ ਉਹਨਾਂ ਨੂੰ ਤਿਆਰ ਕਰਨਾ ਕਿੱਦਾਂ ਮੇਕਅਪ ਕਰਨਾ ਇਹ ਸਾਰਾ ਕੁਛ ਕੀ ਹੈ ਸਾਨੂੰ ਸਿਖਾਇਆ ਜਾਂਦਾ ਜਦੋਂ ਮੀਂਹ ਆਉਂਦਾ ਹੁੰਦਾ ਸੀ ਤਾਂ ਅਸੀਂ ਛੋਟੇ ਹੁੰਦੇ ਕਰਦੇ ਹੁੰਦੇ ਸੀ ਕਿ ਵੱਖ ਵੱਖ ਤਰ੍ਹਾਂ ਦੇ ਕਾਗਜ਼ ਲੈ ਕੇ ਉਹਨਾਂ 'ਤੇ ਕਲਰ ਕਰਕੇ ਉਹਨਾਂ ਦੀਆਂ ਕਿਸ਼ਤੀਆਂ ਬਣਾਉਂਦੇ ਹੁੰਦੇ ਸੀ ਤਾਂ ਉਹਨਾਂ ਕਿਸ਼ਤੀਆਂ ਨੂੰ ਅਸੀਂ ਪਾਣੀ ਵਿੱਚ ਛੱਡਦੇ ਹੁੰਦੇ ਸੀ ਫਿਰ ਅਸੀਂ ਦੇਖਦੇ ਹੁੰਦੇ ਸੀ ਕਿ ਉਹ ਕਿਸ਼ਤੀਆਂ ਕਿੰਨੀ ਦੂਰ ਤੱਕ ਜਾਂਦੀਆਂ ਹਨ ਫਿਰ ਸਾਨੂੰ ਇਹ ਹੁੰਦਾ ਸੀ ਕਿ ਅਸੀਂ ਕਿੰਨੀਆਂ ਕਿੰਨੀਆਂ ਕਿਸ਼ਤੀਆਂ ਬਣਾਉਣੀਆਂ ਹਨ ਤਾਂ ਸਾਡੇ ਵਿੱਚ ਆਪਸੀ ਜੋ ਹੈ ਕੰਪੀਟੀਸ਼ਨ ਹੁੰਦਾ ਸੀ ਅਤੇ ਅਸੀਂ ਦੇਖਦੇ ਹੁੰਦੇ ਸੀ ਕਿ ਸਾਡੀ ਕਿਸ਼ਤੀ ਕਿੱਥੋਂ ਲੈ ਕੇ ਕਿੱਥੋਂ ਤੱਕ ਜਾਂਦੀ ਹੈ ਅਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਿਲਪਕਾਰੀਆਂ ਕਰਦੇ ਰਹੇ ਹਾਂ